ਹਾਂਜੀ ਨਮਸਕਾਰ ਮੈਮ ਆਪ ਹਾਂਜੀ ਆਪ ਹਾਂਜੀ ਓਨਲਾਈਨ ਯੋਗਾ ਸੀਖਾਤੇ ਹੋ ਮੈਮ ਹਾਂਜੀ ਮੈਨੇ ਨਾ ਮੈਂ ਓਨਲਾਈਨ ਯੋਗਾ ਸਿਖਣਾ ਜਿਵੇਂ ਹਾਂਜੀ ਉਹ ਦਰਅਸਲ ਨਾ ਮੈਨੂੰ ਪ੍ਰੋਬਲਮ ਹੋਗੀ ਸੀ ਥੋੜ੍ਹੀ ਜੀ ਅਤੇ ਡੋਕਟਰ ਨੇ ਮੈਨੂੰ ਕਿਹਾ ਵੀ ਤੁਸੀਂ ਯੋਗਾ ਕਰਿਆ ਕਰਨਾ ਹਾਂਜੀ ਅਤੇ ਉਹ ਇਹ ਮੈਨੂੰ ਨਾ ਥੋੜ੍ਹਾ ਜਿਹਾ ਜਿਵੇਂ ਜਿਹੜਾ ਮੇਰਾ ਸਰੀਰ ਆ ਨਾ ਥੋੜ੍ਹਾ ਥੱਕਿਆ ਥੱਕਿਆ ਲੱਗਣ ਲੱਗ ਗਿਆ ਸੀ ਸਰੀਰ 'ਚ ਐਨਰਜੀ ਜਿਵੇਂ ਬਿਲਕੁਲ ਵੀ ਨਹੀਂ ਲੱਗਦੀ ਮੈਨੂੰ ਅਤੇ ਥੋੜ੍ਹਾ ਜਿਹਾ ਨਾ ਮੈਨੂੰ ਮੋਟਾਪਾ ਵੀ ਆਉਂਦਾ ਜਾਂਦਾ ਹਾਂਜੀ ਉਹਦੀ ਵਜ੍ਹਾ ਕਰਕੇ ਨਾ ਮੈਨੂੰ ਮਤਲਬ ਡੋਕਟਰ ਨੇ ਕਿਹਾ ਇੱਕ ਮੈਨੂੰ ਥੋੜ੍ਹਾ ਜਿਹਾ ਨਾ ਮੇਰੀਆਂ ਅੱਡੀਆਂ ਵੀ ਦੁਖਦੀਆਂ ਜਿਵੇਂ ਮੈਂ ਅਗਰ ਬੈਠ ਜਾਂਦੀ ਆ ਨਾ ਤਾਂ ਬੈਠ ਕੇ ਮੈਂ ਉੱਠਦੀ ਹਾਂ ਅਤੇ ਮੇਰੀ ਅੱਡੀਆਂ ਦੁੱਖਦੀਆਂ ਅਤੇ ਅੱਡੀਆਂ 'ਤੇ ਜੋਰ ਨਹੀਂ ਪੈਂਦਾ

ਹਾਂਜੀ ਹਾਂਜੀ ਦਰਅਸਲ ਨਾ ਦਰਅਸਲ ਮੈਮ ਮੈਂ ਨਾ ਤੁਹਾਡੇ ਕੋਲ ਆ ਤਾਂ ਨਹੀਂ ਸਕਦੀ ਗੀ ਮੈਨੂੰ ਤੁਸੀਂ ਓਨਲਾਈਨ ਮਤਲਬ ਅਗਰ ਕਰਵਾ ਦੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਹਾਂਜੀ ਮੈਨੂੰ ਕੋਈ ਗੱਲ ਨਹੀਂ ਤੁਸੀਂ ਸਵੇਰ ਅਤੇ ਸ਼ਾਮ ਦੀ ਟਾਈਮਿੰਗ ਦੱਸ ਦਿਓ ਜਿਹੜੀ ਵੀ ਮਤਲਬ ਤੁਹਾਡੀ ਹੁੰਦੀ ਹੈ ਨਹੀਂ ਤਾਂ ਸੁਬਹਾ ਆਪਾਂ ਜਾਂ ਤਾਂ ਸੂਬਹਾ ਤਾਂ ਛੇ ਵਜੇ ਦੀ ਟਾਈਮ ਰੱਖ ਲੈਂਦੇ ਹਾਂ ਹਾਂਜੀ ਅਤੇ ਸ਼ਾਮ ਨੂੰ ਪੰਜ ਵਜੇ ਹਾਂਜੀ ਹਾਂਜੀ ਸ਼ਾਮ ਨੂੰ ਪੰਜ ਵਜੇ ਕਰ ਲਾਂਗੇ ਜਾਂ ਫੇਰ ਸੱਤ ਵਜੇ ਮੈਂ ਫ੍ਰੀ ਹੁੰਦੀ ਹਾਂ ਉਸ ਤੋਂ ਬਾ ਉਦੋਂ ਕਰ ਲਾਂਗੇ ਅਤੇ ਸੁਬਹਾ ਆਪਾਂ ਛੇ ਵਜੇ ਕਰ ਲਾਂਗੇ

ਹਾਂਜੀ ਹਾਂਜੀ ਹਾਂਜੀ ਫਿਰ ਉਵੇਂ ਹੀ ਕਰਾਂਗੇ ਨਾ ਆਪਾਂ ਹਾਂਜੀ ਕਿੰਨੀ ਪੇਮੈਂਟ ਹੈ ਕਿੰਨੀ ਫੀਸ ਹੈ ਤੁਹਾਡੀ ਅੱਛਾ ਤਿੰਨ ਹਜ਼ਾਰ ਇੱਕ ਹਜ਼ਾਰ ਠੀਕ ਹੈ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਫੀਸ ਦੀ ਤਾਂ ਕੋਈ ਗੱਲ ਨਹੀਂ ਬਸ ਜਿਹੜੀ ਮੈਨੂੰ ਮਤਲਬ ਹੈਗੀ ਆ ਪਰੇਸ਼ਾਨੀ ਮੇਰੀ ਉਹ ਦੂਰ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਉਹ ਤਾਂ ਕੋਈ ਗੱਲ ਨਹੀਂ ਠੀਕ ਹੈ ਆਪਾਂ ਇੱਕ ਸੁਬਹਾ ਛੇ ਵਜੇ ਦਾ ਟਾਈਮ ਰੱਖ ਲੈਂਦੇ ਹਾਂ ਸ਼ਾਮ ਨੂੰ ਫਿਰ ਸੱਤ ਵਜੇ ਦਾ ਰੱਖ ਲੈਂਦੇ ਹਾਂ ਤਾਂ ਕਿ ਅਗਰ ਸ਼ਾਮ ਨੂੰ ਚਾਹ ਵਗੈਰਾ ਪੀਤੀ ਹੁੰਦੀ ਹੈ ਅਤੇ ਉਹ ਵੀ ਮਤਲਬ ਹਜਮ ਹੋ ਜਾਵੇ ਉਦੋਂ ਤੱਕ ਹਾਂਜੀ ਫਿਰ ਮੈਂ ਉਸ ਟਾਈਮ ਹੀ ਕਰ ਲਾਂਗੀ ਕੋਈ ਗੱਲ ਨਹੀਂ ਅਤੇ ਬਸ ਤੁਸੀਂ ਮੈਂ ਹਾਂਜੀ ਹਾਂਜੀ ਛੇ ਵਜੇ ਤੋਂ ਹੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਠੀਕ ਹੈ ਮੈਮ ਠੀਕ ਹੈ ਹਾਂਜੀ ਹਾਂਜੀ